ਹੈਲੋ ਸਤਿ ਸ਼੍ਰੀ ਅਕਾਲ ਵੀਰੇ ਮੈਂ ਨਾ ਆਪਦੀ ਭੈਣ ਦੀ ਇੰਗੇਜਮੈਂਟ ਵਾਸਤੇ ਹਾਂ ਇੱਕ ਫੋਟੋਗ੍ਰਾਫਰ ਚੰਗੇ ਦੀ ਭਾਲ ਕਰ ਰਹੀ ਹਾਂ ਵੀ ਤੁਸੀਂ ਮੈਨੂੰ ਦੱਸੋ ਵੀ ਤੁਹਾਡੇ ਸਰਵਿਸਿਸ ਅਤੇ ਪੈਕਜਿਜ ਬਾਰੇ ਹੈ ਨਾ ਕੀ ਕੀ ਹਿਸਾਬ ਕਿਤਾਬ ਹੈਗਾ ਹਾਂਜੀ ਠੀਕ ਹੈ ਅੱਛਾ ਤੁਸੀਂ ਇਹ ਵਾਰੀ ਹੈ ਨਾ ਜਿਹੜਾ ਅੱਜ ਕੱਲ੍ਹ ਚੱਲੀਆਂ ਹੋਈਆਂ ਨੇ ਹਲਦੀ ਮਹਿੰਦੀ ਦੀ ਰਸਮ ਹੈ ਨਾ ਤੁਸੀਂ ਕਵਰ ਕਰ ਲੈਂਦੇ ਹੋ ਇਹਦੇ ਵੀ ਤੁਸੀਂ ਅਲੱਗ ਤੋਂ ਪੈਸੇ ਲੈਂਦੇ ਹੋ ਵੀ ਉਹਦੇ 'ਚੋਂ ਪੈਕਿਜ 'ਤੇ ਹੀ ਆ ਜਾਂਦਾ ਸਾਰਾ ਠੀਕ ਹੈ ਵੀ ਮੈਨੂੰ ਨਾ ਪਹਿਲਾਂ ਇਹ ਸੀਗਾ ਵੀ ਅਸੀਂ ਨਾ ਵੱਡੇ ਭਰਾ ਵਾਰੀ ਨਾ ਅਸੀਂ ਕੋਈ ਫੋਟੋਗਰਾਫਰ ਕੀਤਾ ਸੀਗਾ ਅਤੇ ਉਹਨਾਂ ਨਾਲ ਸਾਡੀਆਂ ਫੋਟੋਆਂ ਵਗੈਰਾ ਖਰਾਬ ਕਰਤੀਆਂ ਅਤੇ ਵੀਡੀਓ ਵੀ ਉਹਨੇ ਬਣਾਈ ਹੈ ਨਾ ਜਿਹੜੀ ਉਹ ਵੀ ਰੁਕ ਰੁਕ ਕੇ ਚੱਲਦੀ ਮੈਨੂੰ ਇਹ ਨਾ ਹੋਵੇ ਵੀ ਬਾਅਦ 'ਚ ਸ਼ਿਕਾਇਤ ਦਾ ਮੌਕਾ ਵਗੈਰਾ ਨਾ ਦੇਣਾ ਤੁਸੀਂ ਅਤੇ ਮੈਨੂੰ ਬਹੁਤ ਜਣਿਆ ਨੇ ਕਿਹਾ ਵੀ ਤੁਸੀਂ ਵਧੀਆ ਬਣਾਉਂਦੇ ਹੋ ਹੈ ਨਾ ਐਲਬਮ ਵਗੈਰਾ ਵੀ ਵੀਡੀਓ ਸਾਰੀ ਅਤੇ ਫੋ ਹਾਂਜੀ ਵੀ ਇਹ ਇੰਗੇਜਮੈਂਟ ਵਾਲੇ ਪੈਕਜ ਦੇ ਤੁਹਾਡੇ ਕੀ ਰੇਟ ਨੇ ਹਾਂਜੀ ਅਤੇ ਪੈਸੇ ਦੀ ਤਾਂ ਵੈਸੇ ਕੋਈ ਗੱਲ ਨਹੀਂ ਬਸ ਕੰਮ ਵਧੀਆ ਹੋਣਾ ਚਾਹੀਦਾ ਵੀ ਇਹ ਨਾ ਹੋਵੇ ਬਾਅਦ 'ਚ ਹੈ ਨਾ ਸਾਨੂੰ ਉਹ ਕੋਈ ਸ਼ਿਕਵਾ ਜਿਹਾ ਰਹਿ ਜਾਵੇ ਕਿ ਅਸੀਂ ਧਿਆਨ ਨਾਲ ਨਹੀਂ ਕੰਮ ਕੀਤਾ ਵੀ ਤੁਸੀਂ ਮੈਨੂੰ ਪਹਿਲਾਂ ਵਿਖਾ ਸਕਦੇ ਹੋ ਤੁਸੀਂ ਕਿਹੜੇ ਕਿਹੜੇ ਸ਼ੂਟ ਕੀਤੇ ਨੇ ਹੈ ਨਾ ਅਤੇ ਐਲਬਮ ਵਗੈਰਾ ਤੁਸੀਂ ਇੱਕ ਵਾਰੀ ਵਿਖਾਓ ਮੈਨੂੰ ਤੁਸੀਂ ਕਿਹੜਾ ਹੈਗਾ ਤੁਹਾਡਾ ਅੱਛਾ ਇਹ ਤਾਂ ਵਧੀਆ ਫਿਰ ਤਾਂ ਕੈਮਰੇ ਵਗੈਰਾ ਤੁਸੀਂ ਕਿਹੜੀ ਕੰਪਨੀ ਦਾ ਯੂਜ ਕਰਦੇ ਹੋ ਅੱਛਾ ਸਹੀ ਹੈ ਫਿਰ ਤਾਂ ਹੈ ਨਾ ਸੋਨੀ ਦਾ ਤਾਂ ਕੈਮਰਾ ਹੀ ਬੜਾ ਮਹਿੰਗਾ ਆਉਂਦਾ ਹੈਗਾ ਮੈਂ ਸੁਣਿਆ ਹੋਇਆ ਵੈਸੇ ਹਾਂਜੀ ਠੀਕ ਹੈ ਠੀਕ ਹੈ ਵੀ ਸਹੀ ਸੁਣਿਆ ਮੈਂ ਤੁਹਾਡੇ ਬਾਰੇ ਹੈ ਨਾ ਉਹ ਤਾਂ ਜਿਹੜਾ ਕਹਿੰਦੇ ਪਏ ਅੱਜ ਕੱਲ੍ਹ ਗੁਰਦਾਸ ਮਾਨ ਦਾ ਕਿਹੜਾ ਗਾਣਾ ਆਇਆ ਸੀ ਉਹ ਵੀ ਤੁਸੀਂ ਇੱਕ ਸ਼ੂਟ ਕੀਤਾ ਸੀਗਾ ਮੈਨੂੰ ਲੱਗਿਆ ਝੂਠ ਹੈ ਕਿਤੇ ਅੱਛਾ ਫਿਰ ਤਾਂ ਵਧੀਆ ਗੱਲ ਹੈ ਹੈ ਨਾ ਫਿਰ ਤਾਂ ਸਹੀ ਬੰਦੇ ਕੋਲ ਆਏ ਹਾਂ ਅਸੀਂ ਅਤੇ ਵੀਰੇ ਤੁਹਾਡਾ ਕੀ ਕਹਿੰਦੇ ਆ ਆਹਾ ਬਰਾਤ ਜਿਵੇਂ ਰਾਤ ਮਤਲਬ ਇੰਗੇਜਮੈਂਟ ਸਾਨੂੰ ਪਤਾ ਨਹੀਂ ਹੈ ਨਾ ਜੀ ਰਾਤ ਦਾ ਫੰਕਸ਼ਨ ਹੈ ਕਿ ਦਿਨ ਦਾ ਫੰਕਸ਼ਨ ਹੈਗਾ ਅਤੇ ਜੇ ਰਾਤ ਦਾ ਹੋਇਆ ਤਾਂ ਇਹ ਤਾਂ ਨਹੀਂ ਹੋਵੇਗਾ ਵੀ ਉੱਥੇ ਲਾਈਟਨਿੰਗ ਵਗੈਰਾ ਦਾ ਉਹ ਹੋ ਜਾਂਦਾ ਥੋੜ੍ਹਾ ਜਿਹਾ ਦਿੱਕਤ ਜੀ ਆ ਜਾਂਦੀ ਹੈ ਕਿ ਸਹੀ ਹੋਵੇਗਾ ਕੈਮਰੇ ਵਿੱਚ ਸਾਰੇ ਫੋਟੋ ਵਗੈਰਾ ਹਾਂਜੀ ਅੱਛਾ ਅਤੇ ਹੈਲਪਰ ਵਗੈਰਾ ਕਿੰਨੇ ਹੋਣਗੇ ਤੁਹਾਡੇ ਨਾਲ

ਅੱਛਾ ਫਿਰ ਤਾਂ ਨਾ ਹਰ ਐਂਗਲ ਤੋਂ ਸ਼ੂਟ ਕਰ ਲੈਂਦੇ ਹੋਣੇ ਤੁਸੀਂ ਫਿਰ ਵੀ ਜੇ ਅਸੀਂ ਪਰਸਨਲ ਫੋਟੋ ਸ਼ੂਟ ਆਪਦਾ ਕਰਾਉਣਾ ਹੋਇਆ ਹੈ ਨਾ ਜਿਹੜਾ ਰਿਵਾਜ਼ ਚੱਲਿਆ ਹੋਇਆ ਵੀ ਅੱਜ ਕੱਲ੍ਹ ਪ੍ਰੀ ਵੈਡਿੰਗ ਵੀ ਕਰ ਲੈਂਦੇ ਨੇ ਅਟੈਂਡ ਤੇ ਉਹਦੇ ਬਾਰੇ ਪ੍ਰੀ ਵੈਡਿੰਗ ਦਾ ਤੁਹਾਡਾ ਕੀ ਹਿਸਾਬ ਕਿਤਾਬ ਆ ਉਹ ਤਾਂ ਛੋਟਾ ਹੀ ਪੈਕੇਜ ਹੁੰਦਾ ਹੈ ਨਾ ਹਾਂਜੀ ਅਤੇ ਅੱਛਾ ਦਸ ਹਜ਼ਾਰ 'ਚ ਹੋ ਜਾਂਦਾ ਥੋੜ੍ਹਾ ਤੁਸੀਂ ਘੱਟ ਨਹੀਂ ਕਰੋਂਗੇ ਜਿਵੇਂ ਅਸੀਂ ਭੈਣ ਦਾ ਕਰਾਉਣਾ ਹੋਇਆ ਤਾਂ ਅੱਛਾ ਚਲੋ ਠੀਕ ਹੈ ਫਿਰ ਤਾਂ ਹੈ ਨਾ ਬਾਕੀ ਕਲੈਰਟੀ ਵਗੈਰਾ ਵਧੀਆ ਆਵੇ ਵੀ ਹੋਰ ਤਾਂ ਸਾਨੂੰ ਕੀ ਚਾਹੀਦਾ ਹੈ ਨਾ ਕੁੜੀ ਨੇ ਚਲ ਆਪਣੇ ਘਰ ਚਲੇ ਜਾਣਾ ਵਿਆਹ ਵਿਹੁਅ ਕੇ ਬਸ ਫੋਟੋਆਂ ਹੀ ਰਹਿ ਜਾਂਦੀਆਂ ਫੋਟੋਆਂ ਵਧੀਆ ਤਰੀਕੇ ਨਾਲ ਆਉਣੀ ਚਾਹੀਦੀਆਂ ਨੇ ਅਤੇ ਵੀਡੀਓ ਵੀ ਵਧੀਆ ਬਣੇ ਹੁਣ ਨਾਲੇ ਨਾ ਫੰਕਸ਼ਨ ਡਿਸਾਈਡ ਨਹੀਂ ਹੋਇਆ ਵੀ ਦਿਨ ਦਾ ਕਿ ਰਾਤ ਦਾ ਅਤੇ ਉਹ ਤੁਹਾਨੂੰ ਡਿਸਾਈਡ ਕਰਕੇ ਦੱਸ ਦੇਵਾਂਗੇ ਅਤੇ ਬਾਕੀ ਤੁਸੀਂ ਹੁਣ ਮੈਨੂੰ ਉਹ ਦੱਸ ਦਿਓ ਵੀ ਘੱਟੋ ਘੱਟ ਮੁਕਾ ਕੇ ਤੁਸੀਂ ਕਿੰਨੇ ਕੁ ਪੈਸੇ ਲਓਂਗੇ ਵੈਸੇ ਤੁਸੀਂ ਕਹਿ ਰਹੇ ਹੋ ਪ ਪੱਚੀ ਹਜ਼ਾਰ ਲਉਂਗੇ ਹੈ ਨਾ ਅਤੇ ਉਸ ਤੋਂ ਘੱਟ ਨਹੀਂ ਕਰ ਸਕਦੇ ਤੁਸੀਂ ਚਲੋ ਕੋਈ ਨਹੀਂ ਉਹਦਾ ਠੀਕ ਹੈ ਚਲੋ ਹੁਣ ਨਾ ਮੈਂ ਆਪਦੇ ਪਾਪਾ ਨਾਲ ਆਵਾਂਗੀ ਬੁਕਿੰਗ ਕਰਵਾਉਣ ਤਾਂ ਤੁਸੀਂ ਆਹ ਥੋੜ੍ਹੇ ਜਿਹੇ ਪੈਸੇ ਫੜ ਲਓ ਠੀਕ ਹੈ ਹਾਂਜੀ ਧੰਨਵਾਦ ਜੀ